ਦੋ ਲੱਖ ਪੈਂਤੀ ਹਜ਼ਾਰ ਪੰਜ ਸੌ ਵੀਹ ਤਿੰਨ ਲੱਖ ਛੱਤੀ ਹਜ਼ਾਰ ਅੱਠ ਸੌ ਵੀਹ ਚਾਰ ਲੱਖ ਛੱਤੀ ਹਜ਼ਾਰ ਅੱਠ ਸੌ ਨੌ ਪੰਜ ਲੱਖ ਪੱਚੀ ਹਜ਼ਾਰ ਪੰਜ ਸੌ ਵੀਹ ਛੇ ਲੱਖ ਛੱਤੀ ਹਜ਼ਾਰ ਨੌ ਸੌ ਤੀਹ